ਹਾਂਜੀ ਤੁਸੀਂ ਕਿਹੜੀਆਂ ਸਾਰਥਕ ਇਨਡੋਰ ਖੇਡਾਂ ਦਾ ਆਨੰਦ ਮਾਣਦੇ ਹੋ ਇਹੋ ਜਿਹੀਆਂ ਖੇਡਾਂ ਜਿਹੜੀਆਂ ਕਿ ਇਨਡੋਰ ਹੋਣ ਘਰ ਦੇ ਅੰਦਰ ਖੇਡੀਆਂ ਜਾਂਦੀਆਂ ਹੋਣ ਇਹੋ ਜਿਹੀਆਂ ਕਈ ਕਾਫ਼ੀ ਅਸੀਂ ਛੋਟੇ ਹੁੰਦੇ ਤੋਂ ਖੇਡਦੇ ਆਏ ਹਾਂ ਜਿੱਦਾਂ ਕੈਰਮ ਕੈਰਮ ਜਿਹੜਾ ਹੈਗਾ ਹੈ ਉਹ ਅਸੀਂ ਚਾਰ ਦੋਸਤ ਮਿਲ ਕਰ ਖੇਡਦੇ ਹੁੰਦੇ ਸੀ ਅਤੇ ਛੁੱਟੀਆਂ ਦੇ ਵਿੱਚ ਉਸ ਦਾ ਬਹੁਤ ਆਨੰਦ ਮਾਣਦੇ ਸੀ ਅਤੇ ਉਸ ਦੇ ਨਾਲ ਸਮਾਂ ਵੀ ਬਹੁਤ ਛੇਤੀ ਬਤੀਤ ਹੋ ਜਾਂਦਾ ਸੀਗਾ ਇਸੇ ਤਰ੍ਹਾਂ ਲੂਡੋ ਹੈ ਲੂਡੋ ਵੀ ਚਾਰ ਹੀ ਮ ਜਣੇ ਮਿਲ ਕੇ ਖੇਡ ਸਕਦੇ ਹਨ ਉਹ ਵੀ ਅਸੀਂ ਖੇਡਦੇ ਸਨ ਵੈਸੇ ਤਾਂ ਦੋ ਜਣੇ ਵੀ ਖੇਡ ਸਕਦੇ ਹਨ ਘੱਟ ਤੋਂ ਘੱਟ ਇਹਦੇ ਵਿੱਚ ਦੋ ਜਣਿਆਂ ਦੀ ਲੋੜ ਹੁੰਦੀ ਹੈ ਅਤੇ ਉਹ ਅਸੀਂ ਖੇਡ ਲੈਂਦੇ ਹਾਂ ਅਤੇ ਉਸਦੇ ਬਾਅਦ ਸੱਪ ਸੀਡੀ ਜਾਣੀ ਕਿ ਸੱਪ ਅਤੇ ਪੌੜੀ ਇਹ ਵੀ ਗੇਮ ਅਸੀਂ ਘਰ ਦੇ ਵਿੱਚ ਖੇਡਦੇ ਰਹੇ ਹਾਂ ਆਪਣੇ ਦੋਸਤਾਂ ਨਾਲ ਮਿਲ ਕੇ ਅਤੇ ਸ਼ਤਰੰਜ ਖੇਡਦੇ ਹਾਂ ਸ਼ਤਰੰਜ ਤਾਂ ਮੇਰੀ ਬਹੁਤ ਹੀ ਇੱਕ ਬਹੁਤ ਹੀ ਅੱਛੀ ਗੇਮ ਹੈ ਜਿਹੜੀ ਮੈਨੂੰ ਬਹੁਤ ਹੀ ਚੰਗੀ ਲੱਗਦੀ ਹੈ ਅਤੇ ਉਹ ਮੈਂ ਖੇਡਦਾ ਹਾਂ ਆਪਣੇ ਦੋਸਤਾਂ ਨਾਲ ਵੀ ਖੇਡ ਲਈ ਦੀ ਹੈ ਹੁਣ ਅੱਜ ਕੱਲ੍ਹ ਤਾਂ ਐਸਾ ਸਮਾਂ ਆ ਗਿਆ ਹੈ ਕਿ ਇਹ ਖੇਡਾਂ ਜਿਹੜੀਆਂ ਹਨ ਹੁਣ ਤਾਂ ਮੋਬਾਈਲਾਂ ਉੱਤੇ ਵੀ ਆ ਗਈਆਂ ਹਨ ਅਤੇ ਅਸੀਂ ਹੁਣ ਇਹ ਨਹੀਂ ਜ਼ਰੂਰੀ ਨਹੀਂ ਹੁੰਦਾ ਕਿ ਬਈ ਕਿਸੇ ਦੇ ਘਰ ਦੇ ਵਿੱਚ ਜਾ ਕੇ ਖੇਡੀਏ ਅਸੀਂ ਇਹ ਗੇਮਾਂ ਹੁਣ ਮੋਬਾਇਲ ਦੇ ਉੱਤੇ ਕਿਸੇ ਦੂਸਰੀ ਜਗ੍ਹਾ ਦੇ ਉੱਪਰ ਕਿਸੇ ਦੂਸਰੀ ਰਾਜ ਦੇ ਵਿੱਚ ਕਿਸੇ ਦੂਸਰੀ ਕੰਟਰੀ ਦੇ ਵਿੱਚ ਵੀ ਅਗਰ ਕੋਈ ਖ ਬੈਠਾ ਹੈਗਾ ਵਾ ਤੁਹਾਡਾ ਯਾਰ ਦੋਸਤ ਤੁਸੀਂ ਉਸ ਦੇ ਨਾਲ ਵੀ ਇਹ ਗੇਮ ਹੁਣ ਬੜੇ ਆਰਾਮ ਨਾਲ ਖੇਡ ਸਕਦੇ ਹੋ ਅਤੇ ਇਸ ਦਾ ਆਨੰਦ ਮਾਣ ਸਕਦੇ ਹੋ